ਐਬਸਟ੍ਰੈਕਟ ਆਰਟ ਡਰਾਇੰਗ ਦਾ ਇੱਕ ਇਸ ਤਰੀਕੇ ਦਾ ਹਿੱਸਾ ਹੈ ਕਿ ਜਿਹਦੇ ਵਿੱਚ ਡਰਾਇੰਗ ਦੇ ਵਿੱਚ ਕਿਸੇ ਖ਼ਾਸ ਫੋਟੋ ਨੂੰ ਯੂਜ ਫੋਟੋ ਨੂੰ ਸ਼ੋ ਨਹੀਂ ਕੀਤਾ ਜਾਂਦਾ ਬਲਕਿ ਰੰਗਾਂ ਦੀ ਵਰਤੋਂ ਕਰਕੇ ਅਤੇ ਹੱਥਾਂ ਨੂੰ ਫਰੀ ਮਤਲਬ ਖੁੱਲ੍ਹੇ ਤੌਰ 'ਤੇ ਵਰਤੋਂ ਕਰਕੇ ਅਤੇ ਉਸ ਦੇ ਨਾਲ ਇਹ ਇਹ ਇੱਕ ਇਸ ਤਰ੍ਹਾਂ ਦਾ ਤਿਆਰ ਕੀਤਾ ਜਾਂਦਾ ਇਸ ਤਰ੍ਹਾਂ ਦੀ ਡਰਾਇੰਗ ਤਿਆਰ ਕੀਤੀ ਜਾਂਦੀ ਆ ਜਿਹੜੀ ਕੁਛ ਨਾ ਕੁਛ ਪ੍ਰਸਤੁਤ ਕਰ ਰਹੀ ਹੋਵੇ ਕਿਸੇ ਨਾ ਕਿਸੇ ਵਿਚਾਰ ਨੂੰ ਜਾਂ ਕਿਸੇ ਨਾ ਕਿਸੇ ਪ੍ਰਕਿਰਿਆ ਨੂੰ ਉਹ ਸ਼ੋ ਕਰਦੀ ਹੁੰਦੀ ਆ ਆਰਟ ਦੇ ਥਰੂ ਅਤੇ ਜਿਹੜਾ ਆਰਟਿਸਟ ਹੁੰਦਾ ਆ ਜਾਂ ਜਿਹੜਾ ਕਲਾਕਾਰ ਹੁੰਦਾ ਆ ਉਹ ਐਬਸਟਰੈਕਟ ਆਈ ਪੇਂਟਿੰਗ ਦੇ ਥਰੂ ਜਾਂ ਡਰਾਇੰਗ ਦੇ ਦੇ ਦੁਆਰਾ ਆਪਣੇ ਵਿਚਾਰਾਂ ਨੂੰ ਦਰਸ਼ਕਾਂ ਦੇ ਵਿ ਦੇ ਨੂੰ ਦੱਸਦਾ ਆ ਕਿ ਉਹ ਕਿਸ ਤਰ੍ਹਾਂ ਦੀ ਵਿਚਾਰ ਰੱਖ ਰਿਹਾ ਹੈ ਕਿਸੇ ਚੀਜ਼ ਦੇ ਬਾਰੇ ਜੋ ਕਿਸ ਤਰ੍ਹਾਂ ਸੋਚਦਾ ਆ ਅਤੇ ਜਿਹੜੀ ਇਹ ਜਿਹੜਾ ਐਬਸਟਰੈਕਟ ਜਾਂ ਮੂਰਤ ਰਚਨਾ ਆ ਇਹਦੇ ਪਿੱਛੇ ਜਿਹੜਾ ਵਿਚਾਰ ਲਿਆ ਜਾਂਦਾ ਆ ਉਹ ਤਾਂ ਇੱਕ ਸਪੈਸ਼ਲ ਇੱਕ ਮਤਲਬ ਖ਼ਾਸ ਚੀਜ਼ ਨੂੰ ਦੇਖ ਕੇ ਲਿਆ ਜਾਂਦਾ ਆ ਪਰ ਪਰ ਉਹਨੂੰ ਉਸ ਤਰੀਕੇ ਨਾਲ ਬਣਾਇਆ ਨਹੀਂ ਜਾਂਦਾ ਉਹਦੇ ਵਿੱਚ ਸਿਰਫ ਇੱਕ ਸਿਰਫ ਰੰਗਾਂ ਦੀ ਵਰਤੋਂ ਕਰਕੇ ਉਸ ਵਿਚਾਰ ਨੂੰ ਪੇਸ਼ ਕੀਤਾ ਜਾਂਦਾ ਆ